ਮੇਰਾ ਮੰਨਣਾ ਇਹ ਹੈ ਕਿ ਕਿ ਰਨਿੰਗ ਇੱਕ ਜੀਵਨ ਦੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਮੈਂ ਆਪ ਇੱਕ ਅਥਲੀਟ ਦਾ ਖਿਡਾਰੀ ਹਾਂ ਅਤੇ ਰਨਿੰਗ ਉਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਰਨਿੰਗ ਸਵੇਰ ਨੂੰ ਅਤੇ ਸ਼ਾਮ ਨੂੰ ਕਰਨਾ ਫਾਇਦੇਮੰਦ ਹੁੰਦੀ ਹੈ ਮੈਂ ਜ਼ਿਆਦਾਤਰ ਸਵੇਰ ਨੂੰ ਰਨਿੰਗ ਕਰਦਾ ਹਾਂ ਸਵੇਰ ਦੀ ਰਨਿੰਗ ਵਿੱਚ ਬੰਦੇ ਦਾ ਸਰੀਰ ਤੰਦ ਖੁੱਲ੍ਹਦਾ ਹੈ ਅਤੇ ਬੰਦੇ ਨੂੰ ਤਾਜ਼ੀ ਹਵਾ ਪ੍ਰਾਪਤ ਹੁੰਦੀ ਹੈ ਜਦੋਂ ਸਵੇਰ ਨੂੰ ਸੂਰਜ ਉੱਗਦਾ ਹੈ ਤਾਂ ਬੰਦੇ ਦਾ ਮਨ ਵੀ ਪ੍ਰਫੁੱਲਿਤ ਹੋ ਜਾਂਦਾ ਹੈ ਅਤੇ ਉਸ ਨੂੰ ਦੇਖ ਕੇ ਬੰਦੇ ਦਾ ਬੰਦੇ ਦੀ ਅੱਧੀ ਟੈਨਸ਼ਨ ਭੁੱਲ ਜਾਂਦੀ ਹਨ ਸਵੇਰ ਦੀ ਰਨਿੰਗ ਵਿੱਚ ਵੀ ਮੈਨੂੰ ਬਹੁਤ ਫਾਇਦਾ ਮਿਲਦਾ ਹੈ ਪਰ ਫਿਰ ਵੀ ਮੈਂ ਸ਼ਾਮ ਦੀ ਰਨਿੰਗ ਨੂੰ ਜ਼ਿਆਦਾ ਪ੍ਰੈਫਰ ਕਰਦਾ ਹਾਂ ਕਿਉਂਕਿ ਸ਼ਾਮ ਨੂੰ ਵੀ ਬੰਦਾ ਰਿਲੈਕਸ ਹੋ ਕੇ ਰਨਿੰਗ ਦੀ ਚੰਗੀ ਭੂਮਿਕਾ ਨਿਭਾਉਂਦਾ ਹੈ ਸ਼ਾਮ ਦੀ ਰਨਿੰਗ ਨਾਲ ਵੀ ਬੰਦਾ ਨਿਰੋਇਆ ਰਹਿੰਦਾ ਹੈ ਅਤੇ ਰਨਿੰਗ ਤੋਂ ਬਾਅਦ ਵੀ ਬੰਦੇ ਨੂੰ ਹੋਰ ਭੁੱਖ ਲੱਗਦੀ ਹੈ ਜਿਸ ਨਾਲ ਸਰੀਰ ਵਿੱਚ ਵਾਧਾ ਹੁੰਦਾ ਹੈ ਅਤੇ ਸਰੀਰ ਦੀ ਭੁੱਖ ਵੀ ਵੱਧਦੀ ਹੈ